ਮੇਰੀ ਮਨਪਸੰਦ ਜਿਹੜੀਆਂ ਮਛਲੀਆਂ ਆ ਰਾਹੂ ਕਟਲਾ ਅਤੇ ਡੂਮ ਹੈ ਅਤੇ ਇਹਨਾਂ ਨੂੰ ਮੈਂ ਖਾਣਾ ਪਸੰਦ ਕਰਦਾ ਹਾਂ ਜ਼ਿਆਦਾਤਰ ਫਰਾਈ ਕਰਕੇ ਖਾਣਾ ਪਸੰਦ ਕਰਦਾ ਹਾਂ ਬਹੁਤ ਘੱਟ ਹੀ ਮੈਂ ਤਰੀ ਬਣਾ ਕੇ ਖਾਂਦਾ ਹਾਂ ਕੋਸ਼ਿਸ਼ ਹੁੰਦੀ ਹੈ ਕਿ ਮੈਂ ਜਾਂ ਫਰਾਈ ਜਾਂ ਉਹਨਾਂ ਨੂੰ ਉਹਦੇ ਵਿੱਚ ਤਲ ਕੇ ਖਾਣਾ ਪਸੰਦ ਹੀ ਕਰਦਾ ਹਾਂ